ਆਪਣੇ ਆਪਣੇ ਨਜ਼ਰੀਏ ਦੇ ਅਕੋਰਡਿੰਗ ਫੋਨ ਰਾਹੀਂ ਲਾਈਵ ਪ੍ਰਸਾਰਣ ਦੇਖਦੇ ਹਨ ਤਾਂ ਜੋ ਲੋਕ ਗੁਰਦੁਆਰੇ ਮੰਦਰ ਤੋਂ ਘਰ ਬੈਠੇ ਹੀ ਦਰਸ਼ਨ ਕਰਦੇ ਹਨ ਅਤੇ ਘਰ ਬੈਠੇ ਹੀ ਉਹਨਾਂ ਦੀਆਂ ਵਿਚਾਰ ਗੁਰਬਾਣੀ ਸਰਵਣ ਕਰਦੇ ਹਨ